ਹੈਲੋ ਹਾਂਜੀ ਗੋਇਲ ਟੈਲੀਕੋਮ ਤੋਂ ਗੱਲ ਕਰ ਰਹੇ ਹੋ ਤੁਹਾਡੇ ਤੋਂ ਫੋਨ ਲਿਆ ਸੀ ਦਸ ਅਗਸਤ ਨੂੰ ਇਹ ਸੈਮਸੰਗ ਦਾ ਲਿਆ ਸੀ ਜੀ ਅਤੇ ਮੈਂ ਮਾਨਸਾ ਤੋਂ ਅਤੇ ਉਹ ਫੋਨ 'ਚੋ ਹੁਣ ਨਾ ਦਿੱਕਤ ਆ ਰਹੀ ਹੈ ਉਹ ਸਿੰਮ ਨਹੀਂ ਚੱਕ ਰਿਹਾ ਨੈਟਵਰਕ ਪ੍ਰੋਬਲਮ ਆ ਰਹੀ ਹੈ ਉਹਦੇ 'ਚ ਹਾਂਜੀ ਏ ਵਨ ਹਾਂਜੀ ਇਹ ਨੈਟਵਰਕ ਦੀ ਦਿੱਕਤ ਆ ਰਹੀ ਹੈ ਸਿੰਮ ਨਹੀਂ ਚੱਕ ਰਿਹਾ ਇਹ ਉਹ ਨਹੀਂ ਮੈਨੂੰ ਪਤਾ ਬਟ ਇਹ ਚੱਕ ਨਹੀਂ ਰਿਹਾ ਮੈਂ ਇਹਦੀ ਹਜੇ ਗਰੰਟੀ ਵਰੰਟੀ ਵੀ ਪਈ ਹੈ ਅਤੇ ਮੈਨੂੰ ਜਾਂ ਤਾਂ ਰਿਪਲੇਸਮੈਂਟ ਦੱਸੋ ਜਾਂ ਸਹੀ ਕਰਵਾਉਣ ਦਾ ਦੱਸੋ ਹਾਂਜੀ ਨਹੀਂ ਨਹੀਂ ਉਹ ਤਾਂ ਫੋਨ ਤੁਹਾਡੇ ਤੋਂ ਲਿਆ ਅੱਗੇ ਕੀ ਪੁੱਛੋਗੇ ਤੁਸੀਂ ਦੱਸੋ ਨਾ ਬਟ ਲਿਆ ਤੁਹਾਡੇ ਤੋਂ ਹੈ ਫਿਰ ਇਹ ਸਹੀ ਤਾਂ ਤੁਸੀਂ ਕਰਵਾ ਕੇ ਦਿਉਗੇ ਨਾ ਫਿਰ ਅੱਗੇ ਹਾਂਜੀ ਫਿਰ ਮੈਨੂੰ ਤੁਸੀਂ ਦੱਸ ਦਿਓ ਮੈਂ ਕਦੋਂ ਦੇ ਕੇ ਜਾਵਾਂ ਇਹ ਬਿੱਲ ਵੀ ਪਿਆ ਮੇਰੇ ਕੋਲ ਮੈਂ ਕਦੋਂ ਦੇ ਕੇ ਜਾਵਾਂ ਮੈਨੂੰ ਦੱਸ ਦਿਓ ਇਹ ਮੇਰੇ ਕੋਲ ਬਿੱਲ ਵੀ ਪਿਆ ਅਤੇ ਫੋਨ ਵੀ ਠੀਕ ਹੈ ਜੀ ਅਤੇ ਅਤੇ ਸਹੀ ਕਰਵਾਓਗੇ ਹੁਣ ਕਿ ਇਹ ਰਿਪਲੇਸ ਕਰਵਾ ਕੇ ਦਿਉਗੇ ਠੀਕ ਹੈ ਚਲੋ ਕੋਈ ਗੱਲ ਨਹੀਂ ਮੈਂ ਫਿਰ ਕੱਲ੍ਹ ਨੂੰ ਬਿੱਲ ਅਤੇ ਫੋਨ ਲੈ ਕੇ ਮੈਂ ਤੁਹਾਡੀ ਸ਼ੋਪ 'ਤੇ ਆ ਜਾਵਾਂਗੀ ਕਿੰਨੇ ਤੋਂ ਕਿੰਨੇ ਵਜੇ ਤੱਕ ਓਪਨ ਹੁੰਦੀ ਹੈ ਠੀਕ ਹੈ ਜੀ ਮੈਂ ਕੱਲ੍ਹ ਨੂੰ ਫਿਰ ਫੋਨ ਲੈ ਕੇ ਆ ਜਾਵਾਂਗੀ ਠੀਕ ਹੈ ਜੀ